ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਸਿਹਤ ਸੰਭਾਲ ਦੀ ਗੁਣਵੱਤਾ ਬਹੁਤ ਹੀ ਵਧੀਆ ਹੈ ਜਿਵੇਂ ਕਿ ਜਣੇਪੇ ਦੇ ਟਾਈਮ 'ਤੇ ਔਰਤਾਂ ਦੀ ਮੌਤ ਦਰ ਬਹੁਤ ਘੱਟ ਹੈ ਨਵ ਜਨਮੇ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਕਿਸਮ ਦੀਆਂ ਸਿਹਤ ਸਹੂਲਤਾਂ ਹਨ ਜਿਵੇਂ ਬੱਚੇ ਵੱਡੇ ਹੁੰਦੇ ਹਨ ਉਹਨਾਂ ਦੀਆਂ ਕਈ ਕਿਸਮ ਦੀਆਂ ਜਿਵੇਂ ਮੌਸਮ ਸੰਬੰਧੀ ਜਾਂ ਕਿਸੇ ਹੋਰ ਕਿਸਮ ਦੀਆਂ ਕੋਈ ਵੀ ਬਿਮਾਰੀਆਂ ਦੀ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਹਰ ਇੱਕ ਤਰੀਕੇ ਦਾ ਵਧੀਆ ਕਲੀਨਿਕ ਅਤੇ ਹਸਪਤਾਲ ਮਿਲਦਾ ਹੈ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਵੀ ਕਈ ਕਿਸਮ ਦੀਆਂ ਸਹੂਲਤਾਂ ਨੇ ਇਸ ਤਰ੍ਹਾਂ ਦੇ ਨਾਲ ਹੀ ਜਿਵੇਂ ਕੋਈ ਨਸ਼ੇ ਦਾ ਜਾਂ ਕਿਸੇ ਵੀ ਹੋਰ ਇਹੋ ਜਿਹੀ ਬਿਮਾਰੀ ਦਾ ਕੋਈ ਵੀ ਮਰੀਜ਼ ਹੈ ਤਾਂ ਉਹਨਾਂ ਦੇ ਰੀਹੈਬਿਲੀਟੇਸ਼ਨ ਸੈਂਟਰ ਜਿਹੜੇ ਨੇ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ